ਉਹ ਵਰਾਸਤਾਂ ਹੁੰਦੀਆਂ ਹਨ ਜਿਥੇ ਕਿਸੇ ਖੇਤਰ ਸਮੂਹ ਜਾਂ ਸੰਸਕ੍ਰਿਤੀ ਨਾਲ ਜੁੜੀਆਂ ਹੋਣਗੀਆਂ ਪੰਜਾਬੀ ਸੰਗੀਤ ਅਤੇ ਨਾਚ ਵਿੱਚ ਇਹ ਐਥਨਿਕਸ ਵਧੇਰੇ ਰੂਪ ਵਿੱਚ ਦਰਸਾਏ ਜਾਂਦੇ ਹਨ ਕਿਉਂਕਿ ਇਹ ਸਾਡੇ ਇਤਿਹਾਸ ਸੰਸਕ੍ਰਿਤਿਕ ਮੂਲਾਂ ਤੇ ਪੁਰਾਣੀ ਰਵਾਇਤਾਂ ਨੂੰ ਪ੍ਰਗਟਾਉਂਦੇ ਹਨ ਭੰਗੜਾ ਗਿੱਧਾ ਜੂਮਾਂ ਅਤੇ ਸੰਮੀ ਵਰਗੇ ਨਾਚ ਪੰਜਾਬੀ ਲੋਕ ਵਿਰਾਸਤ ਦੇ ਉੱਤਮ ਉਦਾਹਰਨ ਹਨ ਜਿੰਨਾ ਰਾਹੀਂ ਪੰਜਾਬੀਆਂ ਦੀ ਸ਼ਾਨਦਾਰ ਪਹਿਚਾਣ ਬਣਦੀ ਆ ਇਨਾ ਰਾਹੀ ਹੌਸਲਾ ਜੋਸ਼ ਅਤੇ ਭਾਈਚਾਰੇ ਦੀ ਭਾਵਨਾ ਉਤਸਾਹਸ ਹੁੰਦੀ ਐ ਇਹ ਸਾਡੇ ਲੋਕ ਰਿਵਾਜਾਂ ਨੂੰ ਅੱਗੇ ਵਧਾਉਂਦੇ ਹਨ ਨਵੇਂ ਪੀੜੀਆਂ ਨੂੰ ਆਪਣੇ ਮੂਲ ਨਾਲ ਜੋੜਦੇ ਹਨ ਅਤੇ ਪੰਜਾਬੀ ਸੱਭਿਆਚਾਰ ਦੀ ਮਹਾਨਤਾ ਨੂੰ ਵਿਸ਼ਵ ਪੱਧਰ ਤੇ ਪੁਹੰਚਾਉਂਦੇ ਹਨ ਇਹ ਸੰਗੀਤ ਅਤੇ ਨਾਚ ਨੂੰ ਸਾਨੂੰ ਆਪਣੀ ਪਿਛੋਕੜ ਅਤੇ ਆਪਣੀਆਂ ਪਰਮਪਰਾਵਾਂ ਨਾਲ ਜੋੜਨ ਦੇ ਨਾਲ ਨਾਲ ਮਨੋਰੰਜਨ ਦਾ ਸਾਧਨ ਵੀ ਬਣਦੇ ਹਨ ਇੱਕ ਸੰਘਰਸ਼ਮਈ ਇਤਿਹਾਸ ਰੱਖਣ ਵਾਲੀ ਕੌਮ ਵਜੋਂ ਪੰਜਾਬੀਆਂ ਨੇ ਹਮੇਸ਼ਾ ਆਪਣੇ ਲੋਕ ਨਾਚ ਭੰਗੜਾ ਤੇ ਗੀਤਾਂ ਰਾਹੀ ਹਰ ਖੁਸ਼ੀ ਅਤੇ ਦੁੱਖ ਦਾ ਪਰ ਪ੍ਰਗਟਾਵਾ ਕੀਤਾ ਹੈ ਇਹਨਾਂ ਰਾਹੀਂ ਹੌਸਲਾ ਮਿਹਨਤ ਅਤੇ ਦਿਲਚਸਪੀ ਨੂੰ ਵਧਾਵਾ ਮਿਲਦਾ ਹੈ ਜਿਸ ਨਾਲ ਸਾਡੀ ਕਲਾ ਵਿਰਸਾ ਇਤਿਹਾਸ ਅਤੇ ਵਿਰਾਸਤ ਜਿਉਂਦੀ ਰਹਿੰਦੀ ਹੈ ਤੇ ਨਾਲ ਨਾਲ ਮਨੋਰੰਜਨ ਦਾ ਸਾਧਨ ਵੀ ਬਣਦੇ ਹਨ ਇਸ ਲਈ ਇਕ ਸੰਘਰਸ਼ਮਈ ਰੱਖਣ ਲਈ ਕੌਮ ਵਜੋਂ ਪੰਜਾਬੀਆਂ ਨੇ ਹਮੇਸ਼ਾ ਲੋਕ ਨਾਥ ਤੇ ਗੀਤਾ ਰਾਹੀ ਹਰ ਖੁਸ਼ੀ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ